ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਮਹੱਤਤਾ ਹੈ ਭੰਗੜਾ ਪੰਜਾਬ ਦੀ ਰੂਹ ਹੈ ਇਹ ਸਿਰਫ ਇਕ ਨਾਚ ਹੀ ਨਹੀਂ ਬਲਕਿ ਪੰਜਾਬੀਆਂ ਦਾ ਜੋਸ਼ ਖੁਸ਼ਹਾਲੀ ਅਤੇ ਉਤਸ਼ਾਹ ਦਾ ਪ੍ਰਤੀਕ ਵੀ ਹੈ ਭੰਗੜਾ ਉਹ ਉਤਸ਼ਾਹ ਅਤੇ ਸ਼ਕਤੀ ਹੈ ਜੋ ਕਿਸੇ ਵੀ ਸਮੇਂ ਲੋਕਾਂ ਵਿੱਚ ਨਈਂ ਊਰਜਾ ਭਰ ਸਕਦਾ ਹੈ ਪੰਜਾਬੀ ਸੱਭਿਆਚਾਰ ਵਿੱਚ ਇਹ ਇੱਕ ਵਿਰਾਸਤੀ ਨਾਚ ਹੈ ਜੋ ਵਿਸ਼ੇਸ਼ ਤੌਰ 'ਤੇ ਤਿਉਹਾਰਾਂ ਵਿਆਹ ਸ਼ਾਦੀਆਂ ਅਤੇ ਖੇਤੀਬਾੜੀ ਵਿੱਚ ਕੀਤਾ ਜਾਂਦਾ ਹੈ ਸਮੇਂ ਦੇ ਨਾਲ ਨਾਲ ਭੰਗੜਾ ਪੰਜਾਬ ਦੇ ਤਿਉਹਾਰਾਂ ਦਾ ਮਹੱਤਵਪੂਰਨ ਹਿੱਸਾ ਬਣ ਗਿਆ ਹੈ ਭੰਗੜਾ ਪੁਰਾਣੇ ਸਮਿਆਂ ਵਿੱਚ ਕਿਸਾਨਾਂ ਵੱਲੋਂ ਵਿਸਾਖੀ ਦੇ ਮੌਕੇ 'ਤੇ ਖੇਤੀ ਦੀ ਕਟਾਈ ਕਟਾਈ ਦੀ ਖੁਸ਼ੀ ਵਿੱਚ ਕੀਤਾ ਜਾਂਦਾ ਸੀ ਕਿਸਾਨ ਆਪਣੇ ਸ ਸਖਤ ਮਿਹਨਤ ਦੀ ਥਕਾਵਟ ਨੂੰ ਭੁਲਾਉਣ ਅਤੇ ਖੁਸ਼ੀ ਮਨਾਉਣ ਲਈ ਇਹ ਨੱਚਦੇ ਸਨ ਹੌਲੀ ਹੌਲੀ ਇਹ ਪੰਜਾਬ ਦੇ ਤਿਉਹਾਰਾਂ ਅਤੇ ਵਿਆਹ ਸ਼ਾਦੀਆਂ ਦਾ ਵੀ ਇੱਕ ਅਟੁੱਟ ਹਿੱਸਾ ਬਣ ਗਿਆ ਹੈ ਧੰਨਵਾਦ ਜੀ